ਪੰਜਾਬ ਵਿੱਚ ਕਾਫ਼ੀ ਸਾਰੇ ਸੱਭਿਆਚਾਰ ਹੈਗੇ ਹਨ ਅਤੇ ਉਹਨਾਂ ਦੇ ਸਾਰਿਆਂ ਦਾ ਵੱਖ ਵੱਖ ਸੁਭਾਅ ਹੈਗਾ ਪਰ ਫਿਰ ਵੀ ਪੰਜਾਬ ਵਿੱਚ ਭਾਈਚਾਰਾ ਸਭ ਤੋਂ ਜ਼ਿਆਦਾ ਵਿਖਦਾ ਵਾ ਖੁੱਲ ਕੇ ਵਿਖਦਾ ਵਾ ਅਤੇ ਸਭ ਤੋਂ ਜ਼ਿਆਦਾ ਵਿਖਦਾ ਵਾ ਕਿਉਂਕਿ ਇੱਥੇ ਕੋਈ ਵੀ ਬੰਦਾ ਕਿਸੇ ਨੂੰ ਮਨਾ ਨਹੀਂ ਕਰਦਾ ਕਿਸੇ ਚੀਜ਼ ਤੋਂ ਜਿਵੇਂ ਕੋਈ ਫੈਸਟੀਵਲ ਵਗੈਰਾ ਹੋਵੇ ਕੋਈ ਇਵੈਂਟ ਵਗੈਰਾ ਹੋਵੇ ਤਾਂ ਸਾਰੇ ਲੋਕ ਹਰ ਸੱਭਿਆਚਾਰ ਦੇ ਲੋਕ ਇਕੱਠੇ ਹੋ ਕੇ ਸਾਰੇ ਨਾਲ ਨਾਲ ਮਨਾਉਂਦੇ ਹਨ ਅਤੇ ਹਰ ਇੱਕ ਵਿ ਚੀਜ਼ਾਂ ਵਿੱਚ ਮਦਦ ਵਗੈਰਾ ਕਰਦੇ ਹਨ ਕਿਸੇ ਨੂੰ ਕੋਈ ਪ੍ਰੋਬਲਮ ਦੀ ਪ੍ਰੋਬਲਮ ਨਹੀਂ ਆਉਂਦੀ ਸਾਰੇ ਖੁੱਲ੍ਹ ਕੇ ਮਨਾਉਂਦੇ ਹਨ ਅਤੇ ਆਪਣਾ ਕੋਈ ਵੀ ਕਲਾਵਾਂ ਵਗੈਰਾ ਹੁੰਦੀਆਂ ਹਨ ਉਹ ਖੁੱਲ੍ਹ ਕੇ ਦਿਖਾਉਂਦੇ ਵੀ ਹੈਗੇ ਹਨ ਜਿਵੇਂ ਕਿਸੀ ਕੋਈ ਡਾਂਸ ਵਗੈਰਾ ਹੋ ਕਿਸੀ ਹਰ ਸੱਭਿਆਚਾਰ ਦਾ ਡਾਂਸ ਹੁੰਦਾ ਵਾ ਕਿਸੇ ਸੱਭਿਆਚਾਰਾਂ ਦੀ ਪੇਂਟਿੰਗ ਪੈਟਰਨ ਡਿਜ਼ਾਇਨ ਵਗੈਰਾ ਵੱਖਰੇ ਵੱਖਰੇ ਹੁੰਦੇ ਹਨ ਉਹ ਸਾਰੇ ਖੁੱਲ੍ਹ ਕੇ ਦੇਖਦੇ ਨੇ ਅਤੇ ਹਰ ਕੋਈ ਖੁਸ਼ ਵੀ ਹੁੰਦਾ ਵਾ ਸਾਰੇ ਅਲੱਗ ਅਲੱਗ ਚੀਜ਼ਾਂ ਨੂੰ ਵੇਖ ਵੇਖ ਕੇ ਇੱਕ ਐਜੂਕੇਸ਼ਨ ਵੀ ਇੱਕ ਕਲਾ ਹੀ ਹੋ ਗਈ ਉੱਥੇ ਵੀ ਸਾਰੇ ਐਜੂਕੇਸ਼ਨ ਵਿੱਚ ਵੀ ਸਾਰੇ ਨਾਲ ਬਹਿ ਕੇ ਲੈਂਦੇ ਹਨ ਹਰ ਚੀਜ਼ ਨੂੰ ਪੜ੍ਹਦੇ ਹਨ ਹਰ ਚੀਜ਼ ਦੇ ਬਾਰੇ ਵਿੱਚ ਵੇਖਦੇ ਹਨ ਕਿ ਇਹਦੀ ਕਲਾ ਕਿੱਦਾਂ ਦੀ ਹੈ ਇਹਦੀ ਕਲਾ ਕਿੱਦਾਂ ਦੀ ਹੈ ਅਤੇ ਸਾਰੇ ਵੇਖਦੇ ਹਨ ਕਿ ਕਿੱਦਾਂ ਬਣਾਈ ਵੀ ਜਾਂਦੇ ਹਨ ਸਾਰੇ ਅਲੱਗ ਅਲੱਗ ਚੀਜ਼ਾਂ ਸਿੱਖਦੇ ਹਨ ਕਿ ਹਰ ਇੱਕ ਸੱਭਿਆਚਾਰਾਂ ਦੇ ਬਾਰੇ ਵਿੱਚ ਸਿੱਖਦੇ ਹਨ ਤਾਂ ਕਿ ਉਹਨਾਂ ਨੂੰ ਪਤਾ ਚਲੇ ਕਿ ਹਰ ਸੱਭਿਆਚਾਰ ਕਿੱਦਾਂ ਬਣਿਆ ਅਤੇ ਕਿੱਦਾਂ ਉੱਗਦਾ ਪਿਆ ਅਤੇ ਉਹਨਾਂ ਦਾ ਕੀ ਕੀ ਸ਼ਪੈਸ਼ਲਿਟੀ ਹੈਗੀ ਕੀ ਕੀ ਕੀ ਕਰਦੇ ਇੱਦਾਂ ਦੀਆਂ ਚੀਜ਼ਾਂ ਜਿਹਦੇ ਨਾਲ ਜਿੱਦਾਂ ਜਿਸ ਚੀਜ਼ ਨਾਲ ਉਹ ਇੰਨੇ ਮਸ਼ਹੂਰ ਹੈਗੇ ਜਾਂ ਉਹਨਾਂ ਬਾਰੇ ਚੀਜ਼ਾਂ ਮਸ਼ਹੂਰ ਹੈਗੀਆਂ ਹਨ